ਹਾਂਜੀ ਅਸੀਂ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜਿਸ ਨਾਲ ਅਸੀਂ ਅਸੀਂ ਕੀ ਸਾਰੀ ਦੁਨੀਆ ਬਹੁਤ ਰੋਈ ਹੈ ਉਹ ਹੈ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਇੱਕ ਪੋਇਟ ਲੇਖਕ ਦੇ ਨਾਲ ਨਾਲ ਇੱਕ ਮਹਾਨ ਯੋਧੇ ਸਨ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਦੋਂ ਆਪਾਂ ਹੁੰਦੀ ਵੇਖੀ ਆਪਾਂ ਪੜ੍ਹਿਆ ਇਤਿਹਾਸ ਵਿੱਚ ਸਾਨੂੰ ਬਹੁਤ ਹੀ ਰੋਣਾ ਆਇਆ ਕਿਵੇਂ ਛੋਟੇ ਸਾਹਿਬਜ਼ਾਦੇ ਫਤਿਹਗੜ੍ਹ ਸਾਹਿਬ ਸ਼ਹੀਦ ਕੀਤੇ ਗਏ ਅਤੇ ਬੜੇ ਜਿਹੜੇ ਆਪਣੇ ਸਾਹਿਬਜ਼ਾਦੇ ਨੇ ਉਸ ਚਮਕੌਰ ਸਾਹਿਬ ਸ਼ਹੀਦ ਹੋ ਗਏ ਕਿਵੇਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਦੁੱਖ ਸਹਾਰਿਆ ਉਹ ਆਪਣੇ 'ਤੇ ਲੈ ਕੇ ਸਾਨੂੰ ਬਹੁਤ ਰੋਣਾ ਆਇਆ ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਨੇ ਸਾਡੇ ਛੋਟੇ ਸਾਹਿਬਜ਼ਾਦੇ ਨੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਜੀ ਪੰਜ ਅਤੇ ਸੱਤ ਸਾਲ ਦੇ ਕਿਵੇਂ ਨਿੱਕੇ ਨਿੱਕੀ ਜ਼ਿੰਦਾਂ ਨੀਹਾਂ ਵਿੱਚ ਚਿਣਵਾ ਦਿੱਤੀਆਂ ਅਤੇ ਕਿਵੇਂ ਉਹਨਾਂ ਦੀ ਦਾਦੀ ਮਾਂ ਨੇ ਮਾਤਾ ਗੁਜਰੀ ਜੀ ਨੇ ਉਹ ਵੇਲਾ ਵੇਖਿਆ ਕਿਵੇਂ ਉਹ ਦੁੱਖ ਸਹਾਰਿਆ ਅਤੇ ਕਿਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਇਹ ਸਭ ਜੋ ਜਦੋਂ ਵੀ ਆਪਾਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਬਹੁਤ ਭਾਵੁਕ

ਮਹਿਸੂਸ ਹੁੰਦਾ ਹੈ ਅਤੇ ਸਾਨੂੰ ਉਸ ਵੇਲਾ ਯਾਦ ਆ ਜਾਂਦਾ ਹੈ ਜਦੋਂ ਇਹ ਅਸਲ ਵਿੱਚ ਵਾਪਰਿਆ ਹੋਇਆ